ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਤੁਸ ਤੁਸੀਂ ਕੌਣ ਸਰ ਬਸ ਠੀਕ ਠਾਕ ਰੋਹਿਤ ਸ਼ਰਮਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹੋਰ ਕਿਵੇਂ ਹੋ ਬਸ ਸਭ ਠੀਕ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਤੁਹਾਨੂੰ ਅੱਛਾ ਅ ਕੀ ਗੱਲ ਹੋ ਗਈ ਦੱਸੋ ਯਾਰ ਅੱਛਾ ਅੱਛਾ ਠੀਕ ਹੈ ਠੀਕ ਹੈ ਸਰ ਠੀਕ ਹੈ ਆਹੋ ਹਾਂਜੀ ਹਾਂਜੀ ਜੀ ਮੈਂ ਤੁਹਾਡੀ ਪੂਰੀ ਗੱਲ ਸਮਝ ਰਿਹਾ ਅਤੇ ਤੁਹਾਡਾ ਵੈਸੇ ਕਿਸ ਟਾਈਮ ਤੋਂ ਮਤਲਬ ਕਿ ਸਟਾਰਟ ਹੁੰਦੀ ਮੀਟਿੰਗ ਅੱਛਾ ਠੀਕ ਹੈ ਵੈਸੇ ਤਾਂ ਜੋ ਕੰਮ ਜੋ ਹੈ ਕਿ ਹੁਣ ਕੁਛ ਹੀ ਦਿਨਾਂ ਪਹਿਲਾਂ ਹੀ ਸ਼ੁਰੂ ਹੋਇਆ ਅਤੇ ਉਹਦੇ ਕਰਕੇ ਥੋੜ੍ਹਾ ਇਹ ਆ ਕਿ ਮਜ਼ਦੂਰਾਂ ਨੂੰ ਸਮਝਾਉਣਾ ਪਵੇਗਾ ਇਹਨਾਂ ਦੇ ਪਰ ਜਿਵੇਂ ਤੁਸੀਂ

ਹਾਂ ਉਹਦਾ ਹੈ ਸਰ ਜੋ ਵੀ ਕੰਮ ਵਗੈਰਾ ਰਹਿੰਦਾ ਉਹ ਬਾਅਦ 'ਚ ਸਾਫ਼ ਵਗੈਰਾ ਕਰਕੇ ਆਪ ਹੀ ਜਾਂਦੇ ਨੇ ਸਾਰਾ ਕੁਛ ਅਤੇ ਮੈਂ ਕੋਈ ਨਹੀਂ ਤੁਸੀਂ ਦੱਸੋ ਤੁਹਾਨੂੰ ਕਦੋਂ ਤੱਕ ਦਾ ਟਾਈਮ ਚਾਹੀਦਾ ਮੈਂ ਗੱਲ ਕਰ ਕੇ ਦੇਖ ਲੈਂਦਾ ਵਾ ਮਜ਼ਦੂਰ ਹੈਗੇ ਨੇ ਸਿਆਣੇ ਨੇ ਅਤੇ ਹਾਂ ਜੇ ਆਪਾਂ ਗੱਲ ਕਰਾਂਗੇ ਤਾਂ ਉਹ ਸਮਝ ਜਾਣਗੇ

ਦੇਖ ਲੈਂਦੇ ਜੇ ਅਪ ਹਾਂਜੀ ਨਹੀਂ ਨਹੀਂ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਬੈਸਟ ਆਪਾਂ ਇਹ ਹੀ ਹੈ ਕਿ ਇੱਕ ਵਾਰ ਤਾਂ ਵੈਸੇ ਹੀ ਆਪਾਂ ਦੋਵੇਂ ਮਿਲ ਕੇ ਮਜ਼ਦੂਰ ਨਾਲ ਗੱਲ ਕਰ ਲਾਂਗੇ ਜੇ ਉਹਦੇ ਨਾਲ ਗੱਲ ਬਣ ਜਾਂਦੀ ਹੈ ਫਿਰ ਆਪਾਂ ਨੂੰ ਮੀਟਿੰਗ ਵਗੈਰਾ ਦੀ ਕੋਈ ਲੋੜ ਨਹੀਂ ਪਵੇਗੀ ਪਰ ਜੇ ਫਿਰ ਵੀ ਜੇ ਕੁਛ ਹੋ ਸਕਿਆ ਤਾਂ ਫਿਰ ਆਪਾਂ ਬੈਠ ਕੇ ਸਾਰੇ ਸੋਸਾਇਟੀ ਵਾਲੇ ਮੈਂਬਰ ਆਪ ਬੈਠ ਕੇ ਗੱਲ ਕਰ ਲਾਂਗੇ ਠੀਕ ਹੈ ਜਿਵੇਂ ਤੁਹਾਨੂੰ ਠੀਕ ਹੈ ਹਾਂ ਜਿਵੇਂ ਤੁਹਾਨੂੰ ਸਹੀ ਲੱਗੇ ਟਾਈਮ ਉਸ ਹਿਸਾਬ ਨਾਲ ਤੁਸੀਂ ਦੇਖ ਲਿਓ ਬਟ ਇਹ ਹੈ ਕਿ ਹਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਹਦੇ ਵਿੱਚ ਠੀਕ ਹਾਂ ਬਿਲਕੁਲ ਠੀਕ ਹੈ ਹਾਂ ਉਹ ਥੋੜ੍ਹਾ ਕੰਮ ਸੀਗਾ ਬਾਜ਼ਾਰ ਦੇ ਵਿੱਚ ਅਤੇ ਉਹਦੇ ਕਰਕੇ ਮੈਂ ਥੋੜ੍ਹਾ ਬਾਹਰ ਸੀਗਾ

ਬਸ ਮੈਨੂੰ ਇਸ ਨੰਬਰ 'ਤੇ ਮੈਨੂੰ ਕਾਲ ਕਰ ਲਿਓ ਸਵੇਰੇ ਸੋਮਵਾਰ ਨੂੰ ਠੀਕ ਹੈ ਠੀਕ ਹੈ ਬਿਲਕੁਲ ਸਰ ਬਿਲਕੁਲ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ